ਸਾਡੇ ਸ਼ਹਿਰ 'ਚ ਜਿਹੜੀ ਸਟੇਟ ਟ੍ਰਾਂਸਪੋਰਟ ਕੁਆਲਿਟੀ ਬਹੁਤ ਵਧੀਆ ਏ ਈ ਰਿਕਸ਼ਾ ਬੈਟਰੀ ਵਾਲੇ ਬੱਸਾਂ ਬਹੁਤ ਜ਼ਿਆਦਾ ਜ਼ਿਆਦਾ ਚੱਲ ਰਹੀਆਂ ਬੈਟਰੀ ਵਾਲੀਆਂ ਨੋਨ ਪਲਿਊਸ਼ਨ ਹੈ ਅਤੇ ਇੱਥੋਂ ਪੂਰੇ ਪੰਜਾਬ ਜੰਮੂ ਕਸ਼ਮੀਰ ਜਾਂ ਯੂ ਪੀ ਦਿੱਲੀ ਜੈਪੁਰ ਵਗੈਰਾ ਨੂੰ ਟ੍ਰਾਂਸਪੋਰਟੇਸ਼ਨ ਬਹੁਤ ਵਧੀਆ ਬੱਸਾਂ ਜਾਂਦੀਆਂ ਟਰੇਨਸ ਜਾਂਦੀਆਂ ਟ੍ਰੇਨ ਰੇਲਵੇ ਸਟੇਸ਼ਨ ਬੱਸ ਸਟੈਂਡ ਬਹੁਤ ਵਧੀਆ ਅਤੇ ਟੈਕਸੀ ਸਰਵਿਸ ਦਾ ਕੰਮ ਵੀ ਬਹੁਤ ਵਧੀਆ ਜੀ ਟੈਕਸੀ ਹਰ ਪਾਸੇ ਨੂੰ ਇੱਥੋਂ ਟੈਕਸੀ ਪ੍ਰੋਵਾਈਡ ਹੁੰਦੀ ਆ